ਅੱਜ ਕੱਲ੍ਹ ਬਹੁਤ ਸਾਰੇ ਜਿਹੜੇ ਡਾਂਸ ਸ਼ੋਜ ਨੇ ਉਹ ਦਿਖਾਏ ਜਾਂਦੇ ਨੇ ਟੀ ਵੀ ਦੇ ਉੱਤੇ ਜਿਵੇਂ ਡਾਂਸ ਦੀਵਾਨੇ ਹੋ ਗਿਆ ਝਲਕ ਦਿਖਲਾ ਜਾ ਹੋ ਗਿਆ ਹੋਰ ਡਾਂਸ ਪਲਸ ਹੋ ਗਿਆ ਦੁਪਰ ਡਾਂਸਰ ਹੋ ਗਿਆ ਜਿਹੜੇ ਮਤਲਬ ਬੱਚਿਆਂ ਵਾਸਤੇ ਹੁੰਦਾ ਹੈ ਅਤੇ ਇਹਨਾਂ ਸਾਰਿਆਂ ਵਿੱਚ ਜਿਹੜਾ ਉਹ ਡਾਂਸਿੰਗ ਬਾਰੇ ਕਾਫੀ ਕੁਛ ਦੱਸਿਆ ਜਾਂਦਾ ਅਤੇ ਬੱਚੇ ਜਿਹੜੇ ਨੇ ਮਤਲਬ ਕਾਫੀ ਵਧੀਆ ਤਰੀਕੇ ਨਾਲ ਉਹ ਦਿਖਾਉਂਦੇ ਨੇ ਅਤੇ ਲੋਕ ਨਾਚ ਵੀ ਉਹਨਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਵੀ ਉਹਨਾਂ ਦਾ ਜਿਹੜਾ ਪ੍ਰਸਿੱਧ ਲੋਕ ਨਾਚ ਉਹਦੇ 'ਚ ਪੰਜਾਬੀ ਪਰਫੋਰਮੈਂਸਜ ਤਾਂ ਮਿਲਦੀ ਮਤਲਬ ਜਿਹੜੇ ਜਿਹੜੇ ਸਟੇਟ ਦੇ ਉਹ ਹੁੰਦੇ ਨੇ ਉਹ ਆਪਣੀਆਂ ਆਪਣੀਆਂ ਸਟੇਟਜ ਨੂੰ ਵੀ ਰਿਪ੍ਰਜੈਂਟ ਕਰਦੇ ਨੇ ਈਵਨ ਪੰਜਾਬੀ ਡਾਂਸ ਦੀ ਅੱਜ ਕੱਲ੍ਹ ਕਾਫੀ ਜ਼ਿਆਦਾ ਜਿਹੜਾ ਉਹ ਫੇਮਸ ਹੋਇਆ ਹੋਇਆ ਵਾ ਈਵਨ ਜੇ ਤੁਸੀਂ ਇੱਕ ਯੂਟੀਊਬ ਚੈਨਲ ਹੈਗਾ ਲੜਕੀ ਦਾ ਨਾਮ ਇਸ਼ਪ੍ਰੀਤ ਕਰਕੇ ਕੁਛ ਹੈਗਾ ਉਹ ਡਾਂਸ ਲਾਈਵ ਫਿਟ ਨਾਮ ਦਾ ਜਿਹੜਾ ਉਹ ਚੈਨਲ ਚਲਾਉਂਦੀ ਹੈ ਉਹਦੇ ਵਿੱਚ ਜੇ ਤੁਸੀਂ ਦੇਖੋ ਤਾਂ ਉਹ ਉਹਦੇ ਵਿੱਚ ਵੀ ਉਹ ਕਾਫੀ ਮਤਲਬ ਵਧੀਆ ਤਰੀਕੇ ਨਾਲ ਨਾ ਅ ਡਾਂਸ ਵਗੈਰਾ ਹੈਗਾ ਅਤੇ ਉਹ ਸਿਖਾਉਂਦੀ ਵੀ ਹੈ ਮਤਲਵ ਉਹਦੇ ਥਰੂ ਤੁਸੀਂ ਸਿੱਖ ਵੀ ਸਕਦੇ ਹੋ ਕਿ ਵੀ ਹਾਂ ਕਿ ਤੁਸੀਂ ਡਾਂਸ ਕਿੱਦਾਂ ਕਰਨਾ ਤੁਹਾਨੂੰ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਜਾਂ ਜੋ ਵੀ ਹੈ ਉਹ ਸਾਰਾ ਕੁਛ ਉਹਦੇ ਵਿੱਚ ਹੀ ਸਿਖਾਇਆ ਜਾਂਦਾ ਅਤੇ ਜਿਹੜੇ ਟੀ ਵੀ 'ਤੇ ਆਉਂਦੇ ਹੈ ਉਹਦੇ ਵਿੱਚ ਵੀ ਤੁਸੀਂ ਮਤਲਬ ਉਹ ਵੀ ਵਧੀਆ ਤਰੀਕੇ ਨਾਲ ਤੁਹਾਨੂੰ ਦਿਖਾਉਂਦੇ ਨੇ ਅਤੇ ਉਹਦੀਆਂ ਵੀਡੀਓਜ ਵਗੈਰਾ ਵੀ ਵਧੀਆਂ ਹੁੰਦੀਆਂ ਨੇ ਅਤੇ ਮਤਲਬ ਉਹ ਵੀਡੀਓਜ਼ ਵੀ ਦਿਖਾਉਂਦੇ ਨੇ ਅਤੇ ਉਹਦੇ ਜਿਹੜੇ ਲੋਕ ਨਾਚ ਹੁੰਦਾ ਉਹਦੇ 'ਚ ਉਹ ਵੀ ਜਿਹੜਾ ਉਹ ਉਹਨਾਂ ਨੇ ਇਨਵੋਲਵ ਕੀਤਾ ਹੁੰਦਾ ਅਤੇ ਤੁਸੀਂ ਜੇ ਔਨਲਾਈਨ ਦੀ ਗੱਲ ਕਰੋ ਤਾਂ ਔਨਲਾਈਨ ਨੂੰ ਤੁਹਾਨੂੰ ਪ੍ਰੋਪਰ ਸਟੈਪਸ ਵੀ ਸਿਖਾਉਂਦੇ ਨੇ ਕਿ ਤੁਸੀਂ ਔਨਲਾਈਨ ਕਿਸ ਤਰ੍ਹਾਂ ਸਟੈਪਸ ਪ੍ਰੋਪਰ ਸਿੱਖ ਕੇ ਅਤੇ ਡਾਂਸ ਆਪਣਾ ਜਿਹੜਾ ਪਰਫੋਰਮ ਕਰ ਸਕਦੇ ਹੋ